ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਮੈਮ ਅਮੈਰੀਕਨ ਇੰਸਟੀਟਿਊਟ ਤੋਂ ਗੱਲ ਕਰ ਰਹੇ ਹੋ ਬਠਿੰਡਾ ਤੋਂ ਮੈਮ ਮੈਂ ਗੁਰਪ੍ਰੀਤ ਗੱਲ ਕਰ ਰਹੀ ਹਾਂ ਮੈਮ ਮੈਂ ਮੈਂ ਤਲਵੰਡੀ ਸਾਬੋ ਤੋਂ ਗੱਲ ਕਰ ਰਹੀ ਹਾਂ ਹਾਂਜੀ ਮੈਮ ਮੈਂ ਆਈਲੈਸ ਕਰਨਾ ਚਾਹੁੰਦੀ ਹਾਂ ਤਾਂ ਉਹਦੀ ਮੈਂ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ ਹਾਂ ਮੈਮ ਆਈਲੈਸ ਜਿਹੜਾ ਤੁਸੀਂ ਕਰਵਾਉਂਦੇ ਹੋ ਤਾਂ ਇਹ ਕਿੰਨੇ ਟਾਈਮ ਦਾ ਗਾ ਮੈਮ ਤੁਹਾਡੇ ਇੰਸਟੀਟਿਊਟ 'ਚ ਹਾ ਹਾਂਜੀ ਮੈਮ ਅਤੇ ਮੈਮ ਜਿਵੇਂ ਮੈਮ ਮਤਲਬ ਮੇਰੀ ਕੁਆਲੀਫਿਕੇਸ਼ਨ ਦਾ ਮੈਮ ਮੇਰੀ ਗਰੈਜੂਏਸ਼ਨ ਹੈਗੀ ਅਤੇ ਮਤਲਬ ਮੇਰੀ ਜਿਹੜੀ ਇੰਗਲਿਸ਼ ਆ ਉਹ ਮੈਮ ਕੋਈ ਵਾਹਲੀ ਚੰਗੀ ਨਹੀਂ ਹੈਗੀ ਠੀਕ ਠਾਕ ਆ ਤਾਂ ਕਿ ਮੈਨੂੰ ਤਿੰਨ ਮਹੀਨੇ ਤੋਂ ਜ਼ਿਆਦਾ ਟਾਈਮ ਵੀ ਲੱਗ ਸਕਦਾ ਜਾਂ ਤੁਸੀਂ ਬੇਸਿਕ ਇੰਗਲਿਸ਼ ਦੀਆਂ ਕੋਈ ਕਲਾਸਾਂ ਮੈਨੂੰ ਦਿਓਗੇ ਅੱਛਾ ਮਤਲਬ ਪਹਿਲਾਂ ਸਪੋਕਨ ਇੰਗਲਿਸ਼ ਵੀ ਕਰਵਾ ਦੋਗੇ ਅਤੇ ਮੈਮ ਇੰਸਟੀਟਿਊਟ ਦੀ ਵੈਸੇ ਟਾਈਮਿੰਗ ਕੀ ਹੈ ਜੇ ਪੁੱਛਿਆ ਜਾਵੇ ਦਿਨ ਦੇ ਹਿਸਾਬ ਨਾਲ ਮੋਰਨਿੰਗ ਤੋਂ ਸ਼ਾਮ ਤੱਕ ਮੈਮ ਜਿਹੜੀ ਤੁਸੀਂ ਐਕਸਟਰਾ ਕਲਾਸ ਦੀ ਗੱਲ ਕਰ ਰਹੇ ਹੋ ਇਹਦੇ ਲਈ ਫੀਸ ਵਗੈਰਾ ਐਕਸਟਰਾ ਪੇ ਕਰਨੀ ਪੈਣੀ ਆ ਅੱਛਾ ਅਤੇ ਮੈਮ ਵੈਸੇ ਅ ਜਿਵੇਂ ਤਿੰਨ ਮਹੀਨੇ ਦਾ ਆਈਲੈਟਸ ਆ ਤਾਂ ਇਹਦੀ ਫੀਸ ਕਿੰਨੀ ਹੈ ਜੀ ਅੱਛਾ ਅੱਛਾ ਅਤੇ ਜੇ ਅਲੱਗ ਅਲੱਗ ਭਰਦੇ ਹਾਂ ਤਾਂ ਫਿਰ ਕੋਈ ਡਿਸਕਾਊਂਟ ਨਹੀਂ ਹੈਗਾ

ਅੱਛਾ ਤਾਂ ਇਕੱਠੀ ਫੀਸ ਦੇ ਉੱਤੇ ਕਿੰਨਾ ਡਿਸਕਾਊਂਟ ਮਿਲ ਸਕਦਾ

ਅਤੇ ਫਿਰ ਮੈਮ ਤੁਹਾਡਾ ਜਿਹੜਾ ਨਵਾਂ ਬੈਚ ਹੈ ਇਹ ਕਦੋਂ ਸ਼ੁਰੂ ਹੋ ਰਿਹਾ ਹੈਗਾ ਅੱਛਾ ਇਕ ਜੂਨ ਤੋਂ ਹੋ ਜੇਗਾ ਤਾਂ ਮੈਮ ਮਤਲਬ ਮੈਂ ਪਹਿਲਾਂ ਵੀ ਆਈਲੈਟਸ ਕੀਤਾ ਸੀ ਪਰ ਮੇਰਾ ਉਹ ਜਿਹੜਾ ਕਲੀਅਰ ਨਹੀਂ ਹੋਇਆ ਜਿਵੇਂ ਹੁਣ ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਮੈਮ ਜਿੰਨੇ ਬੈਂਡ ਚਾਹੀਦੇ ਸੀ ਓਨੇ ਨਾ ਮੈਨੂੰ ਆ ਨਹੀਂ ਪਾਏ ਮੈਂ ਪਹਿਲਾਂ ਵੀ ਤਿੰਨ ਕੁ ਮਹੀਨੇ ਲਾਏ ਹੋਏ ਨੇ ਕਿਤੇ ਹਾਂ ਤਾਂ ਮੈਨੂੰ ਮਤਲਬ ਬਹੁਤ ਜ਼ਿਆਦਾ ਜਿਹੜੀ ਅਸੀਂ ਕਹਿ ਸਕਦੇ ਮਦਦ ਦੀ ਜ਼ਰੂਰਤ ਹੈਗੀ ਆ ਹਾਂਜੀ ਹਾਂਜੀ ਅੱਛਾ ਤਾਂ ਮੈਮ ਫਿਰ ਮੈਂ ਪਹਿਲਾਂ ਡੈਮੋ ਕਲਾਸਿਸ ਲੈਣਾ ਚਾਹੁੰਦੀ ਹਾਂ ਕੋਈ ਡੈਮੋ ਕਲਾਸਿਸ ਦਾ ਤੁਹਾਡਾ ਹੈਗਾ ਗਾ ਪ੍ਰੋਸੈਸ ਓਕੇ ਤਾਂ ਮੈਮ ਜਿਹੜੀ ਇਹ ਡੈਮੋ ਕਲਾਸ ਮਿਲੂਗੀ ਮੈਮ ਜਿਹੜੀ ਇਹ ਡੈਮੋ ਕਲਾਸ ਮਿਲੂਗੀ ਇਹ ਸਪੋਕਨ ਦੀ ਦਿਓਗੇ ਕਿ ਡਾਇਰੈਕਟ ਆਈਲੈਟਸ ਦੀ ਠੀਕ ਹੈ ਮੈਮ ਓਕੇ ਅੱਛਾ ਠੀਕ ਹੈ ਮੈਮ ਠੀਕ ਹੈ ਮੈਮ ਮੈਂ ਤੁਹਾਨੂੰ ਫਿਰ ਮੈਮ ਕੱਲ੍ਹ ਹੀ ਆ ਕੇ ਮਿਲਾਂਗੀ ਇੰਸਟੀਟਿਊਟ ਦੇ ਵਿੱਚ ਠੀਕ ਹੈ ਓਕੇ ਮੈਮ ਧੰਨਵਾਦ